ਮੈਂ ਇੱਕ ਕਿਤਾਬ ਪੜ੍ਹੀ ਉਸ ਕਿਤਾਬ ਦਾ ਨਾਮ ਸੀ ਕੁਝ ਪਲ ਦੀ ਜ਼ਿੰਦਗੀ ਅਤੇ ਉਹ ਕਿਤਾਬ ਪੜ੍ਹ ਕੇ ਮੈਂ ਬਹੁਤ ਹੀ ਜ਼ਿਆਦਾ ਭਾਵੁਕ ਹੋ ਗਈ ਉਸ ਕਿਤਾਬ ਦੇ ਵਿੱਚ ਕੁਝ ਅਜਿਹੀਆਂ ਲਾਈਨਾਂ ਸੀ ਜਿਹਨਾਂ ਨੇ ਮੈਨੂੰ ਰੋਵਾ ਕੇ ਰੱਖਣ ਦੇ ਲਈ ਮਜ਼ਬੂਰ ਕਰ ਦਿੱਤਾ ਅਤੇ ਮੈਂ ਕਿਤਾਬ ਨੂੰ ਪੜ੍ਹ ਕੇ ਸੱਚ ਮੁੱਚ ਹੀ ਰੋਣ ਲੱਗ ਪਈ ਸੀ ਅਤੇ ਉਸ ਕਿਤਾਬ ਦੇ ਵਿੱਚ ਅਜਿਹੀਆਂ ਗੱਲਾਂ ਸੀ ਕਿ ਉਸ ਤੋਂ ਸਾਨੂੰ ਸਾਡੇ ਜੀਵਨ ਦੇ ਬਾਰੇ ਜਾਣੂ ਕਰਾਇਆ ਹੋਇਆ ਸੀ ਕਿ ਬੰਦੇ ਦੀ ਜ਼ਿੰਦਗੀ ਕੁਝ ਪਲ ਦੀ ਹੀ ਹੁੰਦੀ ਹੈ ਅਤੇ ਬੰਦਾ ਇਸ ਦੁਨੀਆਂ 'ਤੇ ਆਉਂਦਾ ਆ ਲੜ੍ਹਦਾ ਝਗੜਦਾ ਹੀ ਚਲਾ ਜਾਂਦਾ ਆ ਜਦਕਿ ਇਸ ਦੁਨੀਆਂ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਇੱਥੇ ਸਭ ਕੁਝ ਹੀ ਛੱਡ ਕੇ ਅਸੀਂ ਚਲੇ ਜਾਣਾ ਆ ਅਤੇ ਜ਼ਿੰਦਗੀ ਦੇ ਵਿੱਚ ਕੁਝ ਵੀ ਨਾਲ ਨਹੀਂ ਲੈ ਕੇ ਜਾਣਾ ਆ ਅਤੇ ਸਿਰਫ ਇੱਕ ਪਿਆਰ ਹੀ ਹੈ ਜੋ ਸਾਡੇ ਨਾਲ ਜਾਣਾ ਏ ਆ